ਸਤਿ ਸ਼੍ਰੀ ਅਕਾਲ ਸਰ ਸਰ ਮੈਂ ਨਾ ਤੁਹਾਡੀ ਕੈਬ ਬੁੱਕ ਕਰਨਾ ਚਾਹੁੰਦੀ ਸੀ ਆਪਾਂ ਪਹਿਲਾਂ ਵੀ ਕਾਫੀ ਵਾਰ ਮਤਲਬ ਤੁਹਾਡੀ ਕੈਬ ਉੱਤੇ ਗਏ ਹਾਂ ਪਹਿਲਾਂ ਵੀ ਅਸੀਂ ਬੁੱਕ ਕਰਵਾਉਂਦੇ ਰਹੇ ਹਮੇਸ਼ਾ ਜਦੋਂ ਕਿਤੇ ਵੀ ਜਾਣਾ ਹੁੰਦਾ ਤੁਹਾਨੂੰ ਪਹਿਲਾਂ ਹੀ ਦੱਸ ਦਿੰਦੇ ਹਾਂ ਅਤੇ ਸਾਡਾ ਇਸ ਵਾਰ ਵੀ ਅੰਮ੍ਰਿਤਸਰ ਜਾਣ ਦਾ ਪ੍ਰੋਗਰਾਮ ਸੀ ਅਤੇ ਅਸੀਂ ਉੱਥੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨੇ ਆ ਫਿਰ ਉੱਥੋਂ ਹੀ ਜਲਿਆਂਵਾਲੇ ਬਾਗ ਜਾਣਾ ਵਾ ਫਿਰ ਆਪਾਂ ਉੱਥੋਂ ਹੀ ਮਤਲਬ ਸਿੱਧਾ ਵਾਹਗਾ ਬਾਰਡਰ ਜਾਣਾ ਚਾਹੁੰਦੇ ਹਾਂ ਅਤੇ ਤੁਹਾਨੂੰ ਪਤਾ ਹੀ ਆ ਕਿ ਅੱਜ ਕੱਲ੍ਹ ਸਕੂਲਾਂ 'ਚ ਵੀ ਛੁੱਟੀਆਂ ਚੱਲ ਰਹੀਆਂ ਵਾਂ ਜਗ੍ਹਾ ਜਗ੍ਹਾ 'ਤੇ ਰਸ਼ ਵੀ ਬੜਾ ਹੋਇਆ ਪਿਆ ਅਤੇ ਸਾਨੂੰ ਸੀ ਕਿ ਆਪਾਂ ਇੱਥੋਂ ਵੀ ਟਾਈਮ ਨਾਲ ਚੱਲੀਏ ਕਿ ਰਸਤੇ ਵਿੱਚ ਰਸ਼ ਕਰਕੇ ਕੋਈ ਦਿੱਕਤ ਵੀ ਨਾ ਆਵੇ ਅਤੇ ਟਾਈਮ ਦੀ ਵੀ ਨਾ ਹੋਵੇ ਕਿ ਇਹ ਨਾ ਹੋਵੇ ਕਿ ਉੱਥੋਂ ਵੀ ਭੱਜੋ ਭਜਾਈ ਹੋ ਜੇ ਕਿ ਟਾਈਮ ਨਾਲ ਅਸੀਂ ਹਰ ਚੀਜ਼ ਦੇ ਦਰਸ਼ਨ ਵੀ ਨਾ ਕਰ ਸਕੀਏ ਅਤੇ ਇਹ ਹੈਗਾ ਸੀ ਕਿ ਇੱਥੋਂ ਹੀ ਆਰਾਮ ਨਾਲ ਚੱਲੀਏ ਅਤੇ ਆਪਾਂ ਸਮੇਂ ਦੀ ਕੋਈ ਦਿੱਕਤ ਵੀ ਨਾ ਆਵੇ ਅਤੇ ਸਾਰਾ ਕੁਝ ਵਧੀਆ ਵੇਖ ਵੀ ਲਈਏ ਅਸੀਂ ਚਾਰ ਜਣੇ ਆ ਤੁਹਾਨੂੰ ਮਤਲਬ ਕਿ ਤਰਨ ਤਾਰਨ ਨੂੰ ਤਰਨ ਤਾਰਨ ਤੋਂ ਨਾ ਤੁਸੀਂ ਸਾਨੂੰ ਅਠਾਈ ਤਰੀਕ ਨੂੰ ਦਸ ਵਜੇ ਜਿਹੜੀ ਉਹ ਸਰੈਂ ਸਿੰਘ ਵਾਲੀ ਗਲੀ ਹੈ ਨਾ ਉਹਦੇ ਅੰਦਰ ਐਂਟਰ ਹੁੰਦਿਆਂ ਹੀ ਦੂਜਾ ਘਰ ਆ ਉੱਥੋਂ ਤੁਸੀਂ ਸਾਨੂੰ ਪਿਕ ਕਰ ਲਿਓ ਤੁਹਾਨੂੰ ਵੀ ਕੋਈ ਮੁਸ਼ਕਲ ਨਾ ਆਵੇ ਇਸ ਲਈ ਮੈਂ ਦੋ ਦਿਨ ਪਹਿਲਾਂ ਹੀ ਤੁਹਾਨੂੰ ਦੱਸ ਰਹੀ ਹਾਂ ਵੀ ਕਈ ਵਾਰੀ ਇਹ ਹੁੰਦਾ ਕਿ ਕੈਬ ਵੀ ਫਰੀ ਨਹੀਂ ਹੁੰਦੀ ਅਤੇ ਫਿਰ ਇਹ ਆ ਕਿ ਸਾਡਾ ਪ੍ਰੋਗਰਾਮ ਵੀ ਖਰਾਬ ਹੋਊਗਾ ਅਤੇ ਜੇ ਤੁਸੀਂ ਮਤਲਬ ਪਹਿਲਾਂ ਕੋਈ ਭੁਗਤਾਨ ਕਰਵਾਉਣਾ ਹੈ ਉਹ ਵੀ ਤੁਸੀਂ ਦੱਸ ਦਿਉ ਉਹ ਮੈਂ ਤੁਹਾਨੂੰ ਗੂਗਲ ਪੇ ਕਰ ਦੂੰਗੀ ਅਤੇ ਟਾਈਮ ਤਾਂ ਮੈਂ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ ਉਹ ਸਾਰਾ ਵੇਰਵਾ ਵੀ ਦੇ ਤਾ ਤੁਸੀਂ ਕਿੱਥੇ ਪਹੁੰਚਣਾ ਵਾ ਅਤੇ ਫਿਰ ਤੁਸੀਂ ਸਮੇਂ ਨਾਲ ਉਸ ਦਿਨ ਪਹੁੰਚ ਜਿਓ ਕਿ ਤਾਂ ਕਿ ਆਪਾਂ ਵੀ ਸਾਨੂੰ ਵੀ ਮੁਸ਼ਕਲ ਨਾ ਆਵੇ ਅਤੇ ਸਮੇਂ ਨਾਲ ਆਪਾਂ ਚਲੇ ਜੀਏ